ਮੈਂ ਨਾ ਥੋ ਮੈਂ ਨਾ ਤੁਹਾਡੇ ਨਾਲ ਇੱਕ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਸੀਗਾ ਮੈਂ ਨਾ ਇੱਕ ਔਨਲਾਈਨ ਔਰਡਰ ਕੀਤਾ ਸੀਗਾ ਪਲਾਸਟਿਕ ਦੇ ਕੰਟੇਨਰਸ ਜ ਬਹੁਤ ਸੋਹਣੇ ਬੋਕਸ 'ਚ ਸੀਗੀ ਅਤੇ ਮੈਨੂੰ ਬਹੁਤ ਪਿਆਰੇ ਲੱਗੇ ਸੀ ਘਰ ਵਿੱਚ ਉਹਨਾਂ ਦੀ ਜ਼ਰੂਰਤ ਵੀ ਪੈਂਦੀ ਰਹਿੰਦੀ ਆ ਪਲਾਸਟਿਕ ਦੇ ਕੰਟੇਨਰਸ ਦੀ ਇਸ ਲਈ ਮੈਂ ਔਨਲਾਈਨ ਔਰਡਰ ਕਰਤੇ ਸੀ ਉਹ ਪਰ ਜਦੋਂ ਉਹ ਘਰ ਆਏ ਉਦੋਂ ਉਹਨਾਂ ਦਾ ਸਾਈਜ਼ ਵੀ ਬਿਲਕੁਲ ਹੋਰ ਏ ਦਿੱਤਾ ਹੋਇਆ ਸੀ ਦਿਖਾਇਆ ਕੁਛ ਹੋਰ ਸੀਗਾ ਆਇਆ ਕੁਛ ਹੋਰ ਆ ਉੱਪਰ ਉਹਨਾਂ ਦੇ ਢੱਕਣ ਵੀ ਥੋੜ੍ਹੇ ਢਿੱਲੇ ਸੀਗੇ ਪ੍ਰੋਪਰ ਲੱਗ ਨਹੀਂ ਸੀ ਰਹੇ ਜਿਹਦੇ ਕਰਕੇ ਮੈਨੂੰ ਬਹੁਤ ਮੁਸ਼ਕਿਲ ਹੋਈ ਸੀ ਅਤੇ ਮੇਰਾ ਮਨ ਬਹੁਤ ਖਰਾਬ ਹੋਇਆ ਸੀ ਉਹ ਪ੍ਰੋਡਕਟ ਨੂੰ ਦੇਖ ਕੇ ਵੀ ਮੈਂ ਕਿੰਨੇ ਵਧੀਆ ਕਿੰਨੇ ਚਾਅ ਨਾਲ ਉਹ ਔਰਡਰ ਕੀਤੇ ਸੀਗੇ ਪਰ ਉਹ ਵਧੀਆ ਪ੍ਰੋਡਕਟ ਨਹੀਂ ਆਇਆ